ਚਾਰ ਜਨਵਰੀ ਉੱਨੀ ਸੌ ਇਕਹੱਤਰ ਅੱਠ ਮਾਰਚ ਉੱਨੀ ਸੌ ਸਤੱਤਰ ਦਸ ਮਈ ਉੱਨੀ ਸੌ ਬਿਆਸੀ ਬਾਈ ਜੁਲਾਈ ਉੱਨੀ ਸੌ ਬੱਨਵੇਂ ਤੀਹ ਅਕਤੂਬਰ ਦੋ ਹਜ਼ਾਰ ਇੱਕ